ਜੁੱਤੀ ਜੁੱਤੀ ਸਾਡੇ ਦੇਸ਼ ਦੇ ਵਿੱਚ ਬੜੀ ਮਾਂ ਮਾਨਿਅਤਾ ਮਾਨੀ ਜਾਂਦੀ ਜੁੱਤੀ ਦੀ ਜੁੱਤੀ ਸਾਡੇ ਦੇਸ਼ ਦੇ ਵਿੱਚ ਫੁਲਕਾਰੀ ਵਾਲੀ ਮਿਲਦੀ ਹੈ ਕਢਾਈ ਵਾਲੀ ਵੀ ਮਿਲਦੀ ਏ ਅਤੇ ਜਿਹੜੀ ਜੁੱਤੀ ਸਾਡੀ ਫੁਲਕਾਰੀ ਵਾਲੀ ਇਹ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਜਾਂਦੀ ਲੋਕ ਵਿਆਹ ਸ਼ਾਦੀ ਵਿੱਚ ਇਸ ਫੁਲਕਾਰੀ ਦੀਆਂ ਜੁੱਤੀਆਂ ਪਾ ਕੇ ਹਾਰਾ ਅਟੈਂਡ ਕਰਦੇ ਨੇ ਅਤੇ ਜੁੱਤੀ ਸ਼ਹਿਰ ਤੋਂ ਬਾਹਰ ਸ਼ਹਿਰ ਦੇ ਵਿੱਚ ਹੋਰ ਕਈ ਦਸ਼ਾ ਕਈ ਦੇਸ਼ਾਂ ਦੇ ਵਿੱਚ ਵਿਕਦੀ ਹੈ ਇਹ ਜੁੱਤੀ ਬਣਦੀ ਲੈਦਰ ਦੀ ਬਣਦੀ ਹੈ ਚਮੜੇ ਦੀ ਵੀ ਬਣਦੀ ਹੈ ਸਾਡੇ ਫਾਜ਼ਿਲਕਾ ਦੀ ਜੁੱਤੀ ਬਹੁਤ ਹੀ ਮਸ਼ਹੂਰ ਹੈ ਅਤੇ ਜਿਹੜਾ ਵੀ ਕੱਪੜਾ ਹੈ ਉਹ ਲੁਧਿਆਣੇ ਦਾ ਬਹੁਤ ਮਸ਼ਹੂਰ ਹੈ ਉਹ ਵੀ ਦੇਸਾਂ ਪ੍ਰਦੇਸਾਂ ਵਿੱਚ